ਗਾਇਕੀ ਦੇ ਸੰਬੰਧ ਵਿੱਚ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਨੂੰ ਪੋਪ ਗਾਇਕੀ ਪਸੰਦ ਹੈ ਕਿਸੇ ਨੂੰ ਸੂਫੀ ਗਾਇਕੀ ਪਸੰਦ ਹੈ ਸਾਡਾ ਅਨੁਭਵ ਇਹ ਹੈ ਕਿ ਉਸ ਗਾਇਕ ਨੂੰ ਸੁਣਨਾ ਪਸੰਦ ਕੀਤਾ ਜਾਂਦਾ ਹੈ ਜਿਸ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਸਤਿੰਦਰ ਸਰਤਾਜ ਕੰਵਰ ਗਰੇਵਾਲ ਅਤੇ ਗੁਰਦਾਸ ਮਾਨ ਜੀ ਹਨ ਜਿਹਨਾਂ ਨੂੰ ਕਿ ਇ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਹੈ ਕਿਉਂਕਿ ਇਹਨਾਂ ਦੀ ਗਾਇਕੀ ਹੈ ਜਿਹੜੀ ਉਹ ਇੱਕ ਪਰਮਾਤਮਾ ਨਾਲ ਗੁ ਅਹ ਲਿੰਕ ਰੱਖਣ ਵਾਲੀ ਗਾਇਕੀ ਹੈ ਅਤੇ ਪਰਿਵਾਰ ਵਿੱਚ ਬੈਠ ਕੇ ਇਹਨਾਂ ਨੂੰ ਸੁਣਿਆ ਜਾ ਸਕਦਾ ਹੈ ਕਿਉਂਕਿ ਗਾਇਕੀ ਉਹ ਹੁੰਦੀ ਹੈ ਜੋ ਤੁਹਾਡੇ ਮਨ ਨੂੰ ਸਕੂਨ ਦੇਵੇ ਇਹਨਾਂ ਗਾਇਕਾਂ ਦੀ ਜਿਹੜੀ ਗਾਇਕੀ ਹੈ ਉਹ ਮਨ ਨੂੰ ਸਕੂਨ ਦੇਣ ਵਾਲੀ ਹੁੰਦੀ ਹੈ ਸਤਿੰਦਰ ਸਰਤਾਜ ਦਾ ਜੋ ਲਾਈਵ ਪ੍ਰੋਗਰਾਮ ਹੈ ਉਹ ਦੇਖਣ ਵਾਲਾ ਹੁੰਦਾ ਹੈ ਕਮਰਵਾਲ ਕੰਵਰ ਗਰੇਵਾਲ ਜੀ ਦਾ ਪ੍ਰੋਗਰਾਮ ਉਹ ਵੀ ਵੇਖਣ ਵਾਲਾ ਹੁੰਦਾ ਕਿਉਂਕਿ ਇਹਨਾਂ ਦੀ ਗਾਇਕੀ ਹੈ ਜਿਹੜੀ ਉਹ ਸਿੱਧੀ ਪਰਮਾਤਮਾ ਨੂੰ ਅ ਪਰਮਾਤਮਾ ਨਾਲ ਸੰਬੰਧ ਰੱਖਣ ਵਾਲੀ ਹੈ ਇਸ ਲਈ ਅਜਿਹੇ ਗਾਇਕਾਂ ਨੂੰ ਹੀ ਸੁਣਨਾ ਪਸੰਦ ਕੀਤਾ ਜਾਂਦਾ ਹੈ ਜੋ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ